ਪੰਜਾਬ 'ਚ ਅਭਿਆਸ ਕੀਤੇ ਗਏ ਵੱਖ ਵੱਖ ਧਰਮ ਅਧਿਆਤਮਿਕ ਜਾਂ ਵਿਅਕਤੀਗਤ ਵਿਕਾਸ ਦੇ ਮੁੱਦੇ ਨੂੰ ਦੇਖਣ ਲਈ ਸਾਨੂੰ ਇਹਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਇਹ ਜਿਵੇਂ ਕਿ ਯੋਗਾ ਮੈਡੀਟੇਸ਼ਨਸ ਅਤੇ ਜ਼ਿੰਦਗੀ ਦੇ ਫਲਸਫ਼ੇ ਇਨ੍ਹਾਂ ਰਿ ਇਨ੍ਹਾਂ ਤੋਂ ਤਾਲੁਕ ਰੱਖਦੇ ਹੋਏ ਕਾਫ਼ੀ ਨੇ ਸੈਮੀਨਾਰ ਵੀ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਜਿਨ੍ਹਾਂ ਰਾਹੀਂ ਲੋਕਾਂ ਨੂੰ ਇਨ੍ਹਾਂ ਨਾਲ ਜੋੜਿਆ ਜਾ ਸਕੇ ਅਤੇ ਲੋਕਾਂ ਦੀ ਜਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ ਜਾਵੇ ਅਤੇ ਜੋ ਸਾਡਾ ਯੂਥ ਗਲਤ ਰਾਹਾਂ 'ਤੇ ਪਿਆ ਹੈ ਉਹ ਯੂਥ ਸਹੀ ਰਾਹ ਫੜ ਸਕੇ ਯੋਗਾ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਦਾ ਜੋ ਜੀਵਨ ਹੈ ਉਹ ਬਹੁਤ ਭੱਜ ਦੌੜ ਵਾਲਾ ਹੋ ਗਿਆ ਹੈ ਜਿਸ ਕਰਕੇ ਸਾਡੀ ਮਾਨਸਿਕ ਅਤੇ ਸਰੀਰਿਕ ਸਿਹਤ ਵੀ ਕੁਝ ਖ਼ਾਸ ਨਹੀਂ ਰਹਿ ਰਹੀ ਅੱਜ ਕੱਲ੍ਹ ਦੀ ਪੀੜ੍ਹੀਆਂ ਨੂੰ ਬਿਮਾਰੀਆਂ ਨੇ ਘੇਰ ਰੱਖਿਆ ਹੈ ਅਤੇ ਜਿਸ ਕਰਕੇ ਸਾਡੇ ਦੇਸ਼ ਦਾ ਅਤੇ ਸਾਡੇ ਜਿਲ੍ਹੇ ਹਰ ਜਗ੍ਹਾ ਦਾ ਵਿਕਾਸ ਰੁਕਿਆ ਹੋਇਆ ਹੈ ਸੋ ਸਾਨੂੰ ਸਾਡੇ ਜਵਾਨ ਪੀੜ੍ਹੀ ਨੂੰ ਖ਼ਾਸ ਕਰ ਇਨ੍ਹਾਂ ਚੀਜ਼ਾਂ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਜਿੰਦਗੀ ਵਿੱਚ ਡਿਸਪਲਿਨ ਲਿਆ ਸਕਣ ਉਹ ਅਨੁਸ਼ਾਸ਼ਨ ਨਾਲ ਰਹਿ ਸਕਣ ਹੋਰ ਵੀ ਕਾਫ਼ੀ ਫ਼ਾਇਦੇ ਹਨ ਜ ਜੋ ਉਨ੍ਹਾਂ ਨੂੰ ਜਿੰਦਗੀ ਜ ਬਿਤਾਉਣ ਦਾ ਢੰਗ ਸਿਖਾਏਗਾ